ਇਸ ਤਰ੍ਹਾਂ ਤਾਂ ਮੈਂ ਖਾਣਾ ਪਕਾਉਣ ਦੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਪਰ ਉਹਨਾਂ ਵਿੱਚੋਂ ਇੱਕ ਮੁਕਾਬਲਾ ਸੀ ਜਿਹਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਮੈਂ ਬਹੁਤ ਵਧੀਆ ਐਕਸਪੀਰੀਅੰਸ ਵੀ ਲਿਆ ਅਤੇ ਇਹਦੇ ਵਾਸਤੇ ਮੈਂ ਯੂਟਿਊਬ ਦੇ ਵਿੱਚ ਆਪਣਾ ਚੈਨਲ ਵੀ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਮੈਂ ਖਾਣਾ ਬਣਾਉਣ ਦੀਆਂ ਵਿਧੀਆਂ ਵੀ ਦੱਸੀਆਂ ਹੋਈਆਂ ਹਨ